ਮੈਂ ਬਹੁਤ ਸਾਰੇ ਫੋਨ 'ਤੇ ਐਪ ਵਰਤੇ ਹਨ ਜਿਹਨਾਂ ਵਿੱਚੋਂ ਕਈ ਆਪਾਂ ਦੇ ਨਾਂ ਮੈਂ ਦੱਸਣ ਜਾ ਰਿਹਾ ਜਿਹਨਾਂ ਵਿੱਚ ਸਭ ਤੋਂ ਪਹਿਲਾਂ ਵਟਸਐਪ ਹੈ ਜਿਸ ਦੀ ਵਰਤੋਂ ਮੈਂ ਕਾਲਜ ਸਟੂਡੈਂਟ ਹੋਣ ਕਰਕੇ ਕਰਦਾ ਹਾਂ ਮੈਨੂੰ ਮੇਰੇ ਕਾਲਜ ਦੁਆਰਾ ਭੇਜੇ ਗਏ ਸਾਰੇ ਮੈਸੇਜ ਇਸੇ ਐਪ 'ਤੇ ਆਉਂਦੇ ਹਨ ਇਸ ਦਾ ਇੱਕ ਗਰੁੱਪ ਬਣਿਆ ਹੈ ਜਿਸ ਵਿੱਚ ਕਲਾਸ ਦੇ ਬਾਕੀ ਸਾਰੇ ਵਿਦਿਆਰਥੀ ਅਤੇ ਟੀਚਰ ਵੀ ਹਨ ਜੋ ਕਿ ਮੈਸੇਜ ਕਰਕੇ ਸਾਰੇ ਸਿਲੇਬਸ ਜਾਂ ਫਿਰ ਕੋਈ ਨਾ ਕੋਈ ਛੁੱਟੀ ਵਗੈਰਾ ਆਦਿ ਬਾਰੇ ਦੱਸਦੇ ਹਨ ਇਸ ਤੋਂ ਇਲਾਵਾ ਇਥੇ ਇਸ ਐਪ 'ਤੇ ਮੈਂ ਆਪਣੇ ਦੋਸਤਾਂ ਨਾਲ ਫੋਨ ਕਰ ਸਕਦਾ ਹਾਂ ਅਤੇ ਵੀਡੀਓ ਕਾਲ ਵੀ ਕਰ ਸਕਦਾ ਅਤੇ ਉਹਨਾਂ ਨਾਲ ਵੀ ਚੈਟ ਕਰਕੇ ਗੱਲਬਾਤ ਕਰ ਸਕਦਾ ਹਾਂ ਇਸ ਇਸ ਐਪ ਦੀ ਵਰਤੋਂ ਕਰਨ ਲਈ ਆਪਣੇ ਫੋਨ ਵਿੱਚ ਪੈਕ ਹੋਵੇ ਜ਼ਰੂਰੀ ਨਹੀਂ ਇਸ ਆਪਾਂ ਕੋਈ ਵਾਈਫਾਈ ਜਾਂ ਫਿਰ ਫੋ ਦੂਜੇ ਫੋਨ ਦੇ ਹੋਟਸਪੋਟ ਛੱਡ ਕੇ ਸਿਰਫ ਇੰਟਰਨੈਟ ਦੀ ਵਰਤੋਂ ਕਰਕੇ ਵੀ ਇਸ ਐਪ ਦੀ ਵਰਤੋਂ ਕਰ ਸਕਦੇ ਹਾਂ ਇਸ ਲਈ ਇਹ ਐਪ ਬਹੁਤ ਹੀ ਜ਼ਿਆਦਾ ਕੰਮ ਦਾ ਐਪ ਹੈ ਇਸ ਤੋਂ ਇਲਾਵਾ ਮੈਂ ਇੰਸਟਾਗ੍ਰਾਮ ਵਰਤਿਆ ਹੈ ਜਿਸ ਉੱਤੇ ਮੈਂ ਰੀਲਾਂ ਆਦਿ ਦੇਖ ਸਕਦਾ ਹਾਂ ਜਿਸ ਔਰ ਇਸ ਤੋਂ ਇਲਾਵਾ ਮੈਂ ਫੋਟੋਆਂ ਵਗੈਰਾ ਵੀ ਦੇਖ ਸਕਦਾ ਹਾਂ ਅਤੇ ਅਪਲੋਡ ਕੀ ਅਪਲੋਡ ਵੀ ਕਰ ਸਕਦਾ ਹਾਂ ਜਿਸ ਨਾਲ ਦੂਜੇ ਵਿਅਕਤੀ ਵੀ ਮੇਰੀ ਫੋਟੋ 'ਤੇ ਵੀਡੀਓ ਸਾਰੀ ਦੇਖ ਸਕਦੇ ਹਨ ਇਸ ਤੋਂ ਇਲਾਵਾ ਮੈਂ ਆਪਣੇ ਦੋਸਤਾਂ ਆਦੀ ਨੂੰ ਮੈਸੇਜ ਕਰ ਸਕਦਾ ਹਾਂ ਅਤੇ ਉਹਨਾਂ ਨਾਲ ਫੋਨ 'ਤੇ ਵੀਡੀਓ ਕਾਲ ਆਦਿ ਵੀ ਕਰ ਸਕਦਾ ਹਾਂ ਅਤੇ ਇਸ ਤੋਂ ਇਲਾਵਾ ਮੈਂ ਫੇਸਬੁਕ ਵੀ ਵਰਤਿਆ ਹੈ ਜਿਸ ਉੱਤੇ ਵੀ ਲੋ ਪੋਸਟਾਂ ਕਰਦੇ ਹਨ ਅਤੇ ਉਸ ਉੱਤੇ ਵੀ ਆਪਾਂ ਫੋਨ 'ਤੇ ਵੀਡੀਓ ਕਾਲ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਇੱਕ ਦੂਜੇ ਨੂੰ ਮੈਸੇਜ ਕਰ ਸਕਦੇ ਹਾਂ ਇਸ ਉੱਤੇ ਆਪਣੇ ਦੁਆਰਾ ਪਾਈ ਗਈਆਂ ਫੋਟੋਜ਼ ਅਤੇ ਵੀਡੀਓ ਦੂਜੇ ਲੋਕ ਜੋ ਕਿ ਆਪਾਂ ਨੂੰ ਜਾਣਦੇ ਵੀ ਨਹੀਂ ਹਨ ਉਹ ਵੀ ਵੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਮੈਂ ਯੂਟੀਊਬ ਵਰਤਿਆ ਹੈ ਯੂਟੀਊਬ ਉੱਤੇ ਲੋਕ ਵੀਡੀਓਜ ਅਤੇ ਸ਼ਾਰਟਸ ਆਦਿ ਪਾਉਂਦੇ ਹਨ ਜੀ ਜਿਸ ਦੀ ਵਰਤੋਂ ਕਰਕੇ ਮੈਂ ਜਿਹਨਾਂ ਨੂੰ ਦੇਖ ਕੇ ਮੈਂ ਆਪਣਾ ਟਾਈਮ ਪਾਸ ਕਰ ਸਕਦਾ ਹਾਂ ਅਤੇ ਉਸ ਤੋਂ ਇਲਾਵਾ ਇਸ 'ਤੇ ਮੈਂ ਜਾਣਕਾਰੀ ਵੀ ਲੈ ਸਕਦਾ ਹਾਂ ਜਿਵੇਂ ਕਿ ਇਸ 'ਤੇ ਪੜ੍ਹਾਈ ਰਿਲੇਟਡ ਵੀਡੀਓਜ ਵੀ ਹਨ ਉਸ ਤੋਂ ਇਲਾਵਾ ਇੱਥੇ ਬਹੁਤ ਕੁਝ ਹੈ ਅਤੇ ਇੱਥੇ ਜਿਵੇਂ ਕੋਈ ਕੰਮ ਕਰਨਾ ਹੋਵੇ ਤਾਂ ਉਸ ਬਾਰੇ ਜਾਣਕਾਰੀ ਵੀ ਲੈ ਸਕਦਾ ਹਾਂ ਅਤੇ ਇਸ ਪ੍ਰਕਾਰ ਇਹ ਬਹੁਤ ਹੀ ਕੰਮ ਦਾ ਐਪ ਹੈ ਇਸ 'ਤੇ ਸ਼ਾਰਟਸ ਆਦਿ ਪਾ ਕੇ ਅਤੇ ਵੀਡੀਓਜ ਵਗੈਰਾ ਪਾ ਕੇ ਜੇ ਇਸ ਇਸ 'ਤੇ ਬਹੁਤ ਸਾਰੇ ਵਿਊ ਆ ਜਾਣ ਤਾਂ ਇਸ ਤੋਂ ਪੈਸੇ ਕਮਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਮੈਂ ਇਸ ਤੋਂ ਇਲਾਵਾ ਮੈਂ ਕਈ ਗੇਮਾਂ ਵੀ ਖੇਡੀਆਂ ਹਨ ਜਿਵੇਂ ਕਿ

ਗੇਮਾਂ ਵੀ ਖੇਡੀਆਂ ਹਨ ਅਤੇ ਇਸ ਤੋਂ ਇਲਾਵਾ ਮੈਂ ਜ਼ੂਮ ਐਪ ਵਰਤਿਆ ਹੈ ਜਿਸ ਤੇ ਮੀਟਿੰਗ ਆਦਿ ਵਗੈਰਾ ਹੁੰਦੀਆਂ ਹਨ ਅਤੇ ਇਸ ਮੀਟਿੰਗਾਂ ਰਾਹੀਂ ਮੈਂ ਉਹਨਾਂ ਵਿੱਚ ਜੁਆਇਨ ਕਰਕੇ ਆਪਣੇ ਲੈਕਚਰ ਆਦਿ ਜਾਂ ਸੈਮੀਨਾਰ ਵਗੈਰਾ ਜੁਆਇਨ ਕਰ ਸਕਦਾ ਹਾਂ